ਸਾਡੇ ਰਾਜ ਵਿੱਚ ਪ੍ਰਤੱਖ ਰੂਪ ਵਿੱਚ ਮਨਾਇਆ ਜਾਂਦੇ ਤਿਉਹਾਰ ਬਹੁਤ ਸਾਰੇ ਹਨ ਸਮਾਗਮ ਕੀਤੇ ਜਾਂਦੇ ਹਨ ਧਾਰਮਿਕ ਤਿਉਹਾਰ ਜਾਂ ਸਮਾਗਮ ਮਨਾਏ ਜਾਂਦੇ ਹਨ ਜਿੱਦਾਂ ਈਦ ਦੀਵਾਲੀ ਕ੍ਰਿਸਮਿਸ ਵਿਸਾਖ ਲੋਹੜੀ ਇਹ ਸਾਰੇ ਤਿਉਹਾਰ ਸਾਡੇ ਇਲਾਕੇ ਵਿੱਚ ਰਾਜ ਵਿੱਚ ਮਨਾਏ ਜਾਂਦੇ ਹਨ ਸਾਡੇ ਦੀਵਾਲੀ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਹੈ ਲੋਕ ਦੀਪਾਵਾਲੀ ਕਰਦੇ ਹਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਈਦ ਮਨਾਈ ਜਾਂਦੀ ਹੈ ਈ ਈਦ ਵੀ ਕ੍ਰਿਸਮਿਸ ਵੀ ਵਿਸਾਖ ਵੀ ਲੋਹੜੀ ਵੀ ਹਰ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਸਾਡੇ